ਬਹੁਤ ਸਾਰੇ ਅਜਿਹੇ ਵਿਸ਼ੇ ਹੈ ਜਿਹਨਾਂ ਉੱਤੇ ਮੈਂ ਲਿਖਣਾ ਤਾਂ ਚਾਹੁੰਦਾ ਹਾਂ ਪਰ ਉਹਨਾਂ ਪਰ ਕਈ ਵਾਰੀ ਸ਼ੱਕ ਇਸ ਤਰ੍ਹਾਂ ਪੈਂਦੀ ਹੈ ਕਿ ਮੈਂ ਜੇ ਉਹਦੇ ਬਾਰੇ ਲਿਖ ਦਿੱਤਾ ਤਾਂ ਮੈਂ ਕਾਨੂੰਨੀ ਤੌਰ 'ਤੇ ਸ਼ਿਕੰਜੇ 'ਚ ਨਾ ਆ ਜਾਵਾਂ ਕਿਉਂਕਿ ਭਾਰਤ ਵਿੱਚ ਬਹੁਤ ਸਾਰੇ ਇਹੋ ਜਿਹੇ ਵਿਸ਼ੇ ਹੈ ਜਿਹਨਾਂ ਨੂੰ ਅਸੀਂ ਛੂਹਣਾ ਚਾਹੁੰਦੇ ਹਾਂ ਲਿਖਣਾ ਲੇਖਕ ਦੀ ਆਪਣੀ ਮਰਜ਼ੀ ਹੈ ਕਿ ਉਹ ਲਿਖਣਾ ਤਾਂ ਚਾਹੁੰਦਾ ਹੈ ਪਰ ਉਹ ਕਈ ਵਾਰੀ ਕਾਨੂੰਨੀ ਤੌਰ 'ਤੇ ਉਹ ਬੰਦਾ ਉਹਦੀ ਜਕੜ ਦੇ ਵਿੱਚ ਆ ਜਾਂਦਾ ਇਸ ਕਰਕੇ ਉਹ ਲਿਖਣ ਤੋਂ ਉਹਦੇ ਇਹੋ ਜਿਹੇ ਵਿਸ਼ਿਆਂ 'ਤੇ ਲਿਖਣ ਤੋਂ ਗੁਰੇਜ਼ ਕਰਦਾ ਏ ਇਸ ਕਰਕੇ ਅਸੀਂ ਵੀ ਕਈ ਵਿ ਵਿਸ਼ੇ ਇਹੋ ਜਿਹੇ ਹੈ ਜਿਹੜੇ ਧਰਮ ਦੀ ਗੱਲ ਕਰ ਲਓ ਜਾਂ ਕੋਈ ਹਿੰਦੂਵਾਦ ਦੀ ਗੱਲ ਕਰ ਲਓ ਮੁਸਲਮਾਨ ਦੀ ਗੱਲ ਕਰ ਲਓ ਜੇ ਵੱਖਰੇ ਵੱਖਰੇ ਧਰਮਾਂ ਨੂੰ ਲੈ ਕੇ ਵੱਖਰੇ ਵੱਖਰੇ ਵਿਸ਼ਿਆਂ ਨੂੰ ਅਸੀਂ ਛੂਹ ਕੇ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਕਈ ਵਾਰੀ ਇੱਦਾਂ ਹੁੰਦਾ ਕਿ ਲਿਖਦੇ ਤਾਂ ਅਸੀਂ ਜ਼ਰੂਰ ਹਾਂ ਉਹ ਸੁਧਾਰਵਾਦੀ ਹੁੰਦੇ ਆ ਪਰ ਉੱਥੇ ਅਸੀਂ ਲਿਖਣ 'ਚ ਗੁਰੇਜ਼ ਕਰ ਦਿੰਦੇ ਹਾਂ ਕਿ ਇਹ ਵਿਸ਼ਾ ਸੰਵੇਦਨਸ਼ੀਲ ਹੈ ਕਿਤੇ ਅਸੀਂ ਕਨੂੰਨੀ ਸ਼ਿਕੰਜੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਫਸਾ ਨਾ ਲਈਏ ਅਤੇ ਸ ਉਹ ਕਈ ਵਾਰੀ ਫਿਰ ਬੰਦਾ ਡਰਦਾ ਵੀ ਹੈ ਜਿਵੇਂ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਵੀ ਹੈ ਔਰ ਉਹ ਲਿਖਣ ਤੋਂ ਬਾਅਦ ਉਹਨਾਂ ਲੇਖਕਾਂ ਨੂੰ ਕਨੂੰਨੀ ਤੌਰ 'ਤੇ ਸਜ਼ਾਵਾਂ ਵੀ ਹੋਈਆਂ ਅਤੇ ਉਹ ਫਸੇ ਵੀ ਹੈ ਭਾਵੇਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੇਸ ਲਾ ਕੇ ਉਹਨਾਂ ਵਿਸ਼ਿਆਂ 'ਤੇ ਲਿਖਣ 'ਤੇ ਆਪਣਾ ਪੱਖ ਰੱਖ ਚੱਕੇ ਰੱਖ ਸਕੇ ਹੈ ਕਿ ਅਸੀਂ ਇਹਨਾਂ ਤੋਂ ਏ ਇੱਦਾਂ ਲਿਖਿਆ ਉਹ ਆਪਣੇ ਪੱਖ ਨੂੰ ਸਪੱਸ਼ਟ ਕਰ ਸਕੇ ਹੈ ਪਰ ਫਿਰ ਵੀ ਭਾਵੇਂ ਉਹ ਬਰੀ ਵੀ ਹੋ ਗਏ ਉਹਨਾਂ ਕੇਸਾਂ 'ਚੋਂ ਪਰ ਇੱਥੇ ਅਸੀਂ ਲਿਖਣ ਤੋਂ ਇਸ ਕਰਕੇ ਗੁਰੇਜ਼ ਕਰਦੇ ਹਾਂ ਕਿ ਅਸੀਂ ਕਿਤੇ ਕਨੂੰਨ ਦੇ ਸ਼ਿਕੰਜੇ 'ਚ ਨਾ ਆ ਜਾਈਏ ਔਰ ਹੋਰ ਵੀ ਬਹੁਤ ਸਾਰੇ ਲੇਖਕ ਇਹੋ ਜਿਹੇ ਹੈਗੇ ਜਿਹੜੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਲਿਖਣਾ ਤਾਂ ਚਾਹੁੰਦੇ ਹੈ ਮੈਂ ਵੀ ਲਿਖਣਾ ਚਾਹੁੰਦਾ ਹਾਂ ਪਰ ਇਸੇ ਕਰਕੇ ਕਈ ਵਾਰੀ ਅਸੀਂ ਚੁੱਪ ਹੋ ਜਾਈਦਾ ਕਿ ਅਸੀਂ ਇਹਨਾਂ ਵਿਸ਼ਿਆਂ ਨੂੰ ਛੂਹ ਕੇ ਆਪਣੇ ਆਪ ਨੂੰ ਕਨੂੰਨ ਦੇ ਸ਼ਿਕੰਜੇ 'ਚ ਨਾ ਫਸ ਜਾਈਏ